ਖੁੱਲ੍ਹੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸੁਰੱਖਿਅਤ ਰਹਿਣ ਦੇ ਕੁਝ ਕੁ ਤਰੀਕੇ ਇਹ ਨੇ ਕਿ ਜਦੋਂ ਖੁੱਲ੍ਹੇ ਪਾਣੀ ਵਿੱਚ ਤੈਰਨਾ ਹੋਵੇ ਤਾਂ ਉਸ ਸਮੇਂ ਏਅਰ ਟਿਊਬਾਂ ਆਪਾਂ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ ਟਿਊਬਾਂ ਜਿਹੜੀਆਂ ਨੇ ਸਾਨੂੰ ਡੁੱਬਣ ਤੋਂ ਬਚਾਉਂਦੀਆਂ ਨੇ ਇਹ ਸਾਨੂੰ ਡੁੱਬਣ ਨਹੀਂ ਦਿੰਦੀਆਂ ਅਤੇ ਇਸ ਤੋਂ ਇਲਾਵਾ ਜਿਹੜੇ ਬੰਦੇ ਇਹਦੇ 'ਚ ਐ ਹੁੰਦਾ ਕਿ ਨਵੀਂ ਨਵੀਂ ਤੈਰਾਕੀ ਸਿੱਖਦੇ ਪਏ ਉਹਨਾਂ ਉਹਨਾਂ ਨੂੰ ਥੋੜ੍ਹੀਆਂ ਡੂੰਘੀਆਂ ਥਾਵਾਂ 'ਤੇ ਨਹੀਂ ਜਾਣਾ ਚਾਹੀਦਾ ਪਹਿਲਾਂ ਹੌਲੀ ਹੌਲੀ ਉੱਪਰ ਵਾਲੀ ਉਹਦੇ ਸਤਾ 'ਤੇ ਰਹਿਣਾ ਚਾਹੀਦਾ ਬਹੁਤੀ ਡੂੰਗੀ ਥਾਂ 'ਤੇ ਨਾ ਜਾਓ ਇਹ ਫਿਰ ਰਿਸਕ ਵਾਲੀ ਗੱਲ ਹੋ ਜਾਂਦੀ ਹੈ ਇਸ ਤੋਂ ਇਲਾਵਾ ਜਿਹੜੇ ਇਹ ਗੱਲ ਹੈ ਕਿ ਜਿਹੜੀਆਂ ਤਿਲਕਣ ਵਾਲੀਆਂ ਚਟਾਨਾਂ ਹੁੰਦੀਆਂ ਉਹ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਉਹਨਾਂ 'ਤੇ ਪੁਰਾਣੀਆਂ ਪਈਆਂ 'ਤੇ ਕਾਈ ਜੰਮ ਜਾਂਦੀ ਹੈ ਐਲਗੀ ਲੱਗੀ ਹੁੰਦੀ ਹੈ ਉੱਥੋਂ ਵੀ ਆਪਣਾ ਬਚਾਅ ਕਰਨਾ ਚਾਹੀਦਾ ਕਿਉਂਕਿ ਉੱਥੇ ਮਤਲਬ ਤੁਸੀਂ ਨੇੜੇ ਪਹੁੰਚੇ ਨਹੀਂ ਕਿ ਨਾਲ ਹੀ ਤੁਸੀਂ ਤਿਲਕ ਸਕਦੇ ਹੋ ਇਸ ਕਰਕੇ ਉੱਥੋਂ ਵੀ ਆਪਣਾ ਆਪ ਦਾ ਬਚਾਅ ਕਰਨਾ ਚਾਹੀਦਾ